ਸਰਕਾਰ ਦੁਬਾਰਾ ਸਾਨੂੰ ਬੜੀਆਂ ਸਹੂਲਤਾਂ ਮਿਲੀਆਂ ਨੇ ਪਹਿਲਾਂ ਤਾਂ ਉਹਨਾਂ ਨੇ ਬਿਜਲੀ ਪਾਣੀ ਫਰੀ ਦੇ ਤਾ ਚੱਲੋ ਅਤੇ ਸਰਕਾਰੀ ਹਸਪਤਾਲ ਬਣਾਏ ਸਰਕਾਰੀ ਸਕੂਲ ਬਣਾਏ ਅਤੇ ਨਾਲ ਸਰਕਾਰੀ ਡਿਸਪੈਂਸਰੀਆਂ ਵੀ ਖੋਲ੍ਹੀਆਂ ਅਤੇ ਜਿਨ੍ਹਾਂ ਵਿੱਚ ਵੀ ਸਰਕਾਰੀ ਜਿਹੜੀ ਡਿਸਪੈਂਸਰੀਆਂ ਸੀ ਉਹ ਫਰੀ ਇਲਾਜ ਕਰਦੇ ਨੇ ਅਤੇ ਸਰਕਾਰੀ ਹਸਪਤਾਲ ਵਿੱਚ ਕਿਸੇ ਵੇਲੇ ਤਾਂ ਚੱਲੋ ਕਿਸੇ ਵੇਲੇ ਤਾਂ ਚੱਲੋ ਦਵਾਈਆਂ ਮਿਲ ਜਾਂਦੀਆਂ ਨੇ ਮੁਫ਼ਤ ਜਿਹੜੀਆਂ ਸਸਤੀਆਂ ਦਵਾਈਆਂ ਹੁੰਦੀਆਂ ਉਹ ਮੁਫ਼ਤ ਦੇ ਦਿੰਦੇ ਨੇ ਅਤੇ ਜਿਹੜੀਆਂ ਮਹਿੰਗੀਆਂ ਦਵਾਈਆਂ ਨੇ ਅਤੇ ਉਹ ਬਾਜ਼ਾਰੋਂ ਕਹਿੰਦੇ ਨੇ ਲੈ ਲਓ ਕਿਸੇ ਵੇਲੇ ਇੰਨੀ ਇੰਨੀ ਦੂਰੋਂ ਲੋਕ ਆਉਂਦੇ ਨੇ ਕਿਸੇ ਵੇਲੇ ਤਾਂ ਆਪਣੀ ਸੀਟ 'ਤੇ ਡਾਕਟਰ ਬੈਠੇ ਹੁੰਦੇ ਨੇ ਅਤੇ ਕਿਸੇ ਵੇਲੇ ਤਾਂ ਡਾਕਟਰ ਜਿਹੜੇ ਉੱਠ ਕੇ ਚੱਲੇ ਜਾਂਦੇ ਨੇ ਅਤੇ ਆਮ ਦੁਨੀਆਂ ਵਿਚਾਰੀ ਲਾਈਨਾਂ 'ਚ ਖੜ੍ਹੀ ਜਦੋਂ ਡਾਕਟਰ ਨਹੀਂ ਹੁੰਦੇ ਤਾਂ ਉਹਨਾਂ ਨੂੰ ਮਜ਼ਬੂਰੀ ਘਰ ਵਾਪਸ ਜਾਣਾ ਪੈਂਦਾ ਅਤੇ ਸਰਕਾਰ ਨੇ ਜਿਹੜਾ ਇਹ ਮੁਫ਼ਤ ਸਾਰੇ ਇਲਾਜ ਉਪਲੱਬਧ ਕਰਵਾਏ ਹੋਏ ਨੇ ਅਤੇ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਜਿਹੜੇ ਅਸੀਂ ਸਰਕਾਰੀ ਸਕੂਲ ਸਰਕਾਰੀ ਹਸਪਤਾਲ ਅਤੇ ਸਰਕਾਰੀ ਡਿਸਪੈਂਸਰੀਆਂ ਖੋਲ੍ਹੀਆਂ ਨੇ ਉਹਨਾਂ ਨੂੰ ਜਾ ਕੇ ਦੇਖਣਾ ਚਾਹੀਦਾ ਕੀ ਇਹ ਚੰਗੀ ਤਰ੍ਹਾਂ ਕੰਮ ਵੀ ਕਰਦੇ ਪਏ ਕਿ ਨਹੀਂ ਡਾਕਟਰ ਅਤੇ ਆਮ ਦੁਨੀਆ ਉੱਥੇ ਜਾ ਕੇ ਬਹਿ ਕੇ ਫਿਰ ਮਹਿੰਗੇ ਇਲਾਜ ਜਿਹੜੇ ਨੇ ਉਹ ਡਾਕਟਰ ਕਹਿੰਦੇ ਨੇ ਕਿ ਤੁਸੀਂ ਆਪੇ ਕਰਵਾਓ ਅਤੇ ਜਿਹੜੇ ਸਸਤੇ ਨੇ ਛੋਟੇ ਮੋਟੇ ਇਲਾਜ ਹੁੰਦੇ ਨੇ ਉਹ ਕਹਿ ਦਿੰਦੇ ਨੇ ਕਰ ਲਓ ਅਤੇ ਇਹ ਦੇਖਣਾ ਚਾਹੀਦਾ ਤੁਹਾਨੂੰ ਧੰਨਵਾਦ ਜੀ